ਟੈਕਨੋਲੋਜੀ ਨੇ ਸਾਡੇ ਖੇਤਰ ਵਿੱਚ ਏਕਤਾ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਜਿਵੇਂ ਕਿ ਹੁਣ ਅਲੱਗ ਅਲੱਗ ਤਿਉਹਾਰ ਆਪਣੇ ਦੇਸ਼ ਵਿੱਚ ਮਨਾਏ ਜਾਂਦੇ ਹਨ ਟੈਕਨੋਲੋਜੀ ਇਹਨਾਂ ਤਿਉਹਾਰਾਂ ਰਾਹੀਂ ਆਪਾਂ ਦੇਖਦੇ ਹਨ ਅਲੱਗ ਅਲੱਗ ਵੀਡੀਓ ਕਿ ਅਲੱਗ ਅਲੱਗ ਜਾਤੀ ਦੇ ਲੋਕ ਕਿਵੇਂ ਇੱਕੋ ਤਿਉਹਾਰ ਵਿੱਚ ਇੱਕ ਜੁੱਟ ਹੋ ਕੇ ਉਸ ਤਿਉਹਾਰ ਨੂੰ ਸੈਲੀਬ੍ਰੇਟ ਉਸ ਤਿਉਹਾਰ ਨੂੰ ਮਨਾਉਂਦੇ ਹਨ ਆਪਾਂ ਦੇਖਦੇ ਹਨ ਕਿ ਹਰੇਕ ਜਾਤੀ ਦਾ ਲੋਕ ਹਰੇਕ ਤਿਉਹਾਰ ਮਨਾਉਂਦਾ ਹੈ ਅਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦਾ ਹੈ ਇਹ ਆਪਣੇ ਇਸ ਤਰ੍ਹਾਂ ਦੀਆਂ ਵੀਡੀਓ ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੀਆਂ ਜਿਹੜੇ ਵੀ ਆਪਣੇ ਸਮਾਜ ਵਿੱਚ ਫੈਲਦੀਆਂ ਹਨ ਉਹਨਾਂ ਨੂੰ ਦੇਖ ਆਪਾਂ ਇਹਨਾਂ ਚੀਜ਼ਾਂ ਵੱਲ ਜਾਂਦੇ ਹਨ ਕਿ ਸਾਡੇ ਸਮਾਜ ਵਿੱਚ ਕਿੰਨਾ ਭਾਈਚਾਰਕ ਹੈ ਪਰ ਦੂਜੇ ਪਾਸੇ ਆਪਾਂ ਦੇਖਦੇ ਹਨ ਕੁਝ ਇਹੋ ਜਿਹੇ ਲੋਕ ਜੋ ਕਿ ਹਿੰਸਾ ਪੈਦਾ ਕਰਦੇ ਹਨ ਅਤੇ ਲ ਗਲਤ ਵੀਡੀਓ ਜਿਹੜੀਆਂ ਕਿ ਇੱਕ ਦੂਜੇ ਖਿਲਾਫ ਭੜਕਾਊ ਹਨ ਜਿਹੜੀ ਧਰਮ ਨੂੰ ਤੋੜਦੀਆਂ ਹਨ ਜਿਹੜੀਆਂ ਕਿ ਇੱਕ ਦੂਜੇ ਵਿੱਚ ਤਰਕਾ ਤਕਰਾਰ ਪੈਦਾ ਕਰਦੀਆਂ ਹਨ ਉਹੋ ਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨਾਲ ਕੀ ਹੈ ਸਾਡੀ ਭਾਈਚਾਰਕ ਸਾਂਝ ਟੁੱਟਦੀ ਜਾਂਦੀ ਹੈ ਅਤੇ ਅਸੀਂ ਇੱਕ ਦੂਜੇ ਤੋਂ ਧਾਰਮਿਕ ਤੌਰ 'ਤੇ ਵਿਰੋਧ ਕਰਨ ਲੱਗ ਜਾਂਦੇ ਹਨ ਇਹ ਜਿਹੀਆਂ ਵੀਡੀਓਸ ਆਪਾਂ ਹਰ ਰੋਜ਼ ਰੋਜ਼ਾਨਾ ਦੇਖਦੇ ਹਨ ਪਰ ਸਾਨੂੰ ਇਹੋ ਜਿਹੀਆਂ ਵੀਡਿਓ ਤੋਂ ਗੁਰੇਜ਼ ਕਰਨਾ ਚਾਹੀਦਾ ਹੈ